ਮੇਰਾ ਪਸੰਦੀਦਾ ਗੀਤ ਤਾਂ ਵੈਸੇ ਬਹੁਤ ਨੇ ਪਰ ਜਿਹੜਾ ਮੈਨੂੰ ਆਰਾਮ ਨਾਲ ਜਿਹੜਾ ਜ਼ਿਆਦਾਤਰ ਮੇਰੇ ਮੂੰਹ 'ਚ ਆਉਂਦਾ ਹੈ ਉਹ ਹੈ ਸਿੱਧੂ ਮੂਸੇਵਾਲੇ ਦਾ ਮਹਿੰਗੇ ਨੇ ਮੋਤੀ ਜੋ ਹਾਸਲ ਨਹੀਂ ਹੋਣੇ ਇਹ ਵੱਸ ਦੀ ਨਾ ਗੱਲ ਇਹ ਗਰੀਬਾਂ ਦੇ ਇਸ ਗਾਣੇ ਦੇ ਬੋਲ ਬਹੁਤ ਸੋਹਣੇ ਨੇ ਇਹਦਾ ਸੰਗੀਤ ਬਹੁਤ ਸੋਹਣਾ ਹੈ ਸਿੱਧੂ ਮੂਸੇਵਾਲਾ ਜੋ ਕਿ ਹੁਣ ਮਰਹੂਮ ਹੋ ਚੁੱਕਾ ਹੈ ਸਾਡੇ ਵਿੱਚ ਨਹੀਂ ਹੈ ਬਟ ਇਸ ਦੇ ਗਾਣੇ ਤਕਰੀਬਨ ਚਲਦੇ ਰਹਿੰਦੇ ਨੇ ਬਾਕੀ ਹੋਰ ਵੀ ਗਾਣੇ ਬਹੁਤ ਨੇ ਜਿਵੇਂ ਗੈਰੀ ਸੰਧੂ ਦੇ ਹੋ ਗਏ ਗੁਰਦਾਸ ਮਾਨ ਦੇ ਹੋ ਗਏ ਇਹ ਵੀ ਚਲਦੇ ਰਹਿੰਦੇ ਹਨ ਨਿੰਜਾ ਹੈ ਉਸਦੇ ਗਾਣੇ ਵੀ ਸੁਣੀ ਦੇ ਹਨ ਸਾਡਾ ਪਸੰਦੀਦਾ ਗਾਣਾ ਤੁਹਾਨੂੰ ਇੱਕ ਸੁਣਾ ਤਾ ਇੱਕ ਥੋੜ੍ਹਾ ਜਿਹਾ ਨਿੰਜੇ ਦਾ ਸੁਣਾ ਦਿੰਦੇ ਹਾਂ ਰੋਈ ਨਾ ਜੇ ਯਾਦ ਮੇਰੀ ਆਈ ਵੇ ਇਸਦੇ ਬੋਲ ਬਹੁਤ ਸੋਹਣੇ ਹਨ ਸੰਗੀਤ ਵੀ ਬਹੁਤ ਸੋਹਣਾ ਹੈ ਇਹ ਕਿਤੇ ਹਾਈਵੇ 'ਤੇ ਜਾਂਦੇ ਹੋਵੋ ਲੰਬੀ ਰੂਟ 'ਤੇ ਪਈ ਪਾਈ ਹੋਵੇ ਗੱਡੀ ਅਤੇ ਗਾਣਾ ਸੁਣਦੇ ਹੋਵੋ ਅਤੇ ਬਹੁਤ ਹੀ ਮਜ਼ਾ ਆਉਂਦਾ ਹੈ ਗਾਣੇ ਤਾਂ ਸਾਰੇ ਪਸੰਦ ਨੇ ਜੀ ਬਾਕੀ ਮੂੰਹ 'ਤੇ ਕੋਈ ਕੋਈ ਚੜ੍ਹਦਾ ਅਤੇ ਗਾਉਣਾ ਕੋਈ ਕੋਈ ਆਉਂਦਾ